ਛੇਵੇਂ ਦਿਨ ਨਵ ਜੰਮੇ ਬੱਚੇ ਦੀ ਛਠੀ ਕੀਤੀ ਜਾਂਦੀ ਹੈ ਅਤੇ ਨਵਾਇਆ ਜਾਂਦਾ ਹੈ ਉਸ ਦੀ ਮਾਂ ਨੂੰ ਉਸੇ ਦਿਨ ਚੌਂਕੇ ਵੀ ਚੜ੍ਹਾਇਆ ਜਾਂਦਾ ਹੈ ਅਤੇ ਘਰ ਵਿੱਚ ਕੁਛ ਮਿੱਠਾ ਬਣਾਇਆ ਜਾਂਦਾ ਹੈ ਅਤੇ ਘਰ ਵਿੱਚ ਖੁਸ਼ੀ ਵਾਲਾ ਮਾਹੌਲ ਹੁੰਦਾ ਹੈ ਸਾਰੇ ਗੈਸਟਸ ਨੂੰ ਸੱਦਿਆ ਜਾਂਦਾ ਹੈ ਅਤੇ ਬੈਠ ਕੇ ਮਾਹੋਬ ਖੁਸ਼ੀ ਦਾ ਮਾਹੌਲ ਸੈਲੀਬਰੇਟ ਕੀਤਾ ਜਾਂਦਾ ਹੈ ਫਿਰ ਉਸ ਬੱਚੇ ਦਾ ਸਿੱਖ ਬੱਚੇ ਦਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਕਸ਼ਰ ਲੱਭ ਕੇ ਨਾਮਕਰਨ ਕੀਤਾ ਜਾਂਦਾ ਹੈ ਨਾਮ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਪਹਿਲਾ ਅਕਸ਼ਰ ਆਉਂਦਾ ਉਹ ਤੋਂ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ਫਿਰ ਉਸ ਦੇ ਕੇਸ ਗੁਣੇ ਜਾਂਦੇ ਹਨ ਸਿੱਖਾਂ ਦੇ ਬੱਚਿਆਂ ਦੇ ਕੇਸ ਗੁਰੂ ਘਰ ਤੋਂ ਗੁਣਵਾਏ ਜਾਂਦੇ ਹਨ ਅਤੇ ਹਿੰਦੂਆਂ ਦੇ ਬੱਚਿਆਂ ਦਾ ਮੁੰਡਨ ਕੀਤਾ ਜਾਂਦਾ ਹੈ ਕਈ ਕਿਸੀ ਕਿਸੀ ਫੈਮਲੀਆਂ ਵਿੱਚ ਤਿੰਨ ਮਹੀਨੇ ਤੋਂ ਬਾਅਦ ਬੱਚੇ ਦਾ ਕੇਕ ਵੀ ਕੱਟਿਆ ਜਾਂਦਾ ਹੈ ਛੇ ਮਹੀਨੇ ਬਾਅਦ ਵੀ ਬੱਚਿਆਂ ਦਾ ਕੇਕ ਕੱਟਿਆ ਜਾਂਦਾ ਹੈ ਵਿਸਾਖੀ ਵਾਲੇ ਦਿਨ ਉਸ ਬੱਚੇ ਨੂੰ ਚੋਲਾ ਪਵਾਇਆ ਜਾਂਦਾ ਹੈ ਅਕਸਰ ਸਾਰੇ ਮਾਂ ਪਿਓ ਸਾਰੇ ਬ ਮ ਦ ਰਲ ਕੇ ਬੱਚੇ ਦਾ ਪਹਿਲੇ ਪਹਿਲਾ ਜਨਮਦਿਨ ਵੀ ਬਹੁਤ ਖੁਸ਼ੀ ਨਾਲ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ